ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਵਧੀਆ ਬਹੁਤ ਬਹੁਤ ਵਧੀਆ ਹੋਰ ਸਕੂਲ ਵਧੀਆ ਚਲਦਾ ਹਾਂ ਅੱਛ ਹਾਂਜੀ ਹਾਂਜੀ ਅਸੀਂ ਵੀ ਇੱਥੋਂ ਦਸਵੀਂ ਪਾਸ ਕੀਤੀ ਆ ਹਾਂ ਹੁਣ ਅਸੀਂ ਸਕੂਲ ਵੀ ਵਧੀਆ ਇੱਥੋਂ ਗ੍ਰੈਜੂਏਸ਼ਨ ਤਾਂ ਕਰਕੇ ਲਾਗੇ ਪਾਸਿਓ ਹੁਣ ਗੁਜਰਾਤ ਵਿੱਚ ਆਏ ਹੋਏ ਹਾਂ ਹਾਂ ਅਗਲੀ ਸਟੱਡੀ ਇੱਥੇ ਕਰਨੀ ਹਮ ਹਾਂ ਮੌਸਮ ਤਾਂ ਵਧੀਆ ਰਹਿੰਦਾ ਹੁਣ ਮੈਂ ਸੁਣਿਆ ਠੰਡ ਵਾ ਅੱਛਾ ਕਿੰਨਾਂ ਟੈਂਪਰੇਚਰ ਹੋ ਜਾਂਦਾ ਅੱਛਾ ਰਾਤ ਵੇਲੇ ਦਾ ਹੋਣਾ ਨਾ ਨਾ ਇੰਨਾ ਤਾਂ ਨਹੀਂ ਹੋ ਜਾਂਦਾ ਸੀ ਚਲੋ ਛੇ ਸੱਤ ਡਿਗਰੀ ਤੱਕ ਹੁਣ ਅਸੀਂ ਨਾਲ ਗਏ ਅਸੀਂ ਇੱਥੋਂ ਗਏ ਅਤੇ ਗੁਜਰਾਤ ਵੀ ਟੈਂਪਰੇਚਰ ਰਹਿੰਦਾ ਨਾ ਉੱਥੇ ਮੌਸਮ ਸਹੀ ਆ ਹਮ ਅਤੇ ਅੱਜ ਕੱਲ੍ਹ ਕਿਸ ਤਰ੍ਹਾਂ ਦਾ ਸੂਰਜ ਵਗੈਰਾ ਵਿਖਦਾ ਕਿ ਨਹੀਂ ਅੱਛਾ ਧੁੱਪ ਧੁੱਪ ਤਿੱਖੀ ਆ ਅੱਛਾ ਅੱਛਾ ਹਾਂ ਹਾਂ ਚਲੋ ਲੱਗਦਾ ਚੱਕਰ ਤਾਂ ਫਿਰ ਮਿਲਦੇ ਹਾਂ ਹਾਂਜੀ ਹਾਂਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਵੀਰੇ